ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਲ ਹੋਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਅਸੀਂ ਆਪਣੀ ਕਲਾ ਅਤੇ ਸ਼ਿਲਪਕਾਰੀ ਦਿਆਂ ਗੁਣਾਂ ਨੂੰ ਵਧਾ ਸਕਦੇ ਹਨ ਅਸੀਂ ਆਪਣੇ ਗੁਣਾਂ ਦੇ ਲਈ ਨਵੇਂ ਨਵੇਂ ਯੁਕਤੀ ਜਾਂ ਫਿਰ ਯੁਕਤੀ ਨੂੰ ਦੇਖ ਕੇ ਸਕ ਦਿਸ ਦੇਖ ਸਕਦੇ ਹਨ ਜਿਵੇਂ ਕਿ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਯੂਟਿਊਬ ਯੂਟਿਊਬ 'ਤੇ ਸਾਨੂੰ ਬਥੇਰਾ ਕੁਝ ਮਿਲਦਾ ਦੇਖਣ ਨੂੰ ਜਿੱਦਾਂ ਕਿ ਸਾਨੂੰ ਕਾਫੀ ਸਾਰੇ ਚੈੱਨਲਸ ਮਿਲਦੇ ਆ ਦੇਖਣ ਨੂੰ ਜਿਵੇਂ ਕਿ ਯੂਟਿਊਬ ਚੈੱਨਲ ਹੈ ਜਿਹਦਾ ਨਾਮ ਹੈ ਆਰਟ ਐਂਡ ਡਾਂਸ ਇਸ ਚੈੱਨਲ ਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਪਤਾ ਲਗਦਾ ਹੈ ਕਿ ਕਿਵੇਂ ਕੋਈ ਨਵਾਂ ਆਪਣਾ ਕਲਾ ਦਾ ਗੁਣ ਵਧਾਉਣਾ ਹੈ ਕਿਵੇਂ ਕੋਈ ਰੰਗ ਲਾਉਣਾ ਹੈ ਜਿਵੇਂ ਅਸੀਂ ਪੇਂਟਿੰਗ ਕਰਦੇ ਹਨ ਇੱਥੇ ਕਿ ਚਿੱਤਰਕਾਰੀ ਕਰਦੇ ਹਨ ਚਿੱਤਰਕਾਰੀ ਕਰਦੇ ਸਮੇਂ ਸਾਨੂੰ ਕਈ ਸਾਰੀ ਮੁਸਕਲਾਂ ਆਉਂਦੀਆਂ ਹਨ ਕਿ ਕਈ ਵਾਰ ਕੋਈ ਰੰਗ ਨਹੀ ਬਣ ਪਾਉਂਦਾ ਤਾਂ ਉਸ ਰੰਗ ਨੂੰ ਕਿੱਦਾਂ ਦੋ ਚਾਰ ਹੋਰ ਰੰਗਾਂ ਨੂੰ ਆਪਸ 'ਚ ਮਿਲਾ ਕੇ ਬਣਾਉਣਾ ਹੈ ਉਹ ਸਾਰਾ ਕੁਝ ਸਾਨੂੰ ਜਾਣਨ ਨੂੰ ਮਿਲਦਾ ਅਤੇ ਹੋਰ ਵੀ ਬਹੁਤ ਸਾਰੇ ਗੁਣ ਆਪਾਂ ਸਿੱਖ ਸਕਦੇ ਹਨ ਇਨ੍ਹਾਂ ਤੋਂ ਜਿਵੇਂ ਕਈ ਵਾਰ ਸਾਨੂੰ ਕੁਛ ਆਪਣੀ ਚਿੱਤਰਕਾਰੀ ਦੇ ਲਈ ਨਵੀਂ ਨਵੀਂ ਸੋਝ ਚਾਹੀਦੀ ਹੈ ਜਾਂ ਫਿਰ ਨਵਾਂ ਰਾਹ ਚਾਹੀਦਾ ਹੁੰਦਾ ਤਾਂ ਅਸੀਂ ਇਨ੍ਹਾਂ ਤੋਂ ਉਹ ਆਪਣਾ ਰਾਹ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ